ਤੁਸੀਂ ਫਲਿਪਕਾਰਡ ਤੋਂ ਬੋਲਦੇ ਪਏ ਜੇ ਮੈਂ ਨਾ ਤੁਹਾਡੇ ਕੋੋਲੋਂ ਬੈਡਸ਼ੀਟ ਔਡਰ ਕੀਤੀ ਸੀਗੀ ਅਤੇ ਮੈਨੂੰ ਉਹਦੀ ਸਹੀ ਟਾਈਮ 'ਤੇ ਡਿਲੀਵਰੀ ਹੋ ਗਈ ਅਤੇ ਜਦੋਂ ਮੈਂ ਓਪਨ ਕੀਤਾ ਪਾਰਸਲ ਤਾਂ ਮੈਨੂੰ ਬੈਡਸ਼ੀਟ ਦੇਖੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਜਿੱਦਾਂ ਦੀ ਮੈਨੂੰ ਬੈਡਸ਼ੀਟ ਚਾਹੀਦੀ ਸੀਗੀ ਮੈਨੂੰ ਉੱਦਾਂ ਦੀ ਹੀ ਮਿਲ ਗਈ ਅਤੇ ਬੈਡਸ਼ੀਟ ਬਹੁਤ ਹੀ ਵਧੀਆ ਸੀਗੀ ਜਦੋਂ ਮੈਂ ਵਿਛਾਈ ਮੈਨੂੰ ਬਹੁਤ ਵਧੀਆ ਲੱਗੀ ਮੈਂ ਉਹਨੂੰ ਵੋਸ਼ ਕਰਕੇ ਵੀ ਦੇਖਿਆ ਉਹਦਾ ਕਲਰ ਵਗੈਰਾ ਬਿਲਕੁਲ ਨਹੀਂ ਬਿਲਕੁਲ ਨਹੀਂ ਗਿਆ ਕਿਉਂਕਿ ਉਹ ਬਹੁਤ ਹੀ ਵਧੀਆ ਬੈਡਸ਼ੀਟ ਸੀਗੀ ਅਤੇ ਮੈਂ ਮਾਰਕੀਟ ਵਿੱਚ ਵੀ ਪਤਾ ਕੀਤਾ ਮੈਨੂੰ ਉਸ ਤਰ੍ਹਾਂ ਦੀ ਬੈਡਸ਼ੀਟ ਨਹੀਂ ਮਿਲੀ ਜਿਸ ਤਰ੍ਹਾਂ ਦੀ ਮੈਨੂੰ ਫਲਿੱਪਕਾਰਟ ਤੋਂ ਮਿਲ ਗਈ ਅਤੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਬਹੁਤ ਹੀ ਵਧੀਆ ਬੈਡਸ਼ੀਟ ਸੀਗੀ ਜਿੱਦਾਂ ਦੀ ਮੈਨੂੰ ਚਾਹੀਦੀ ਮੈਨੂੰ ਉੱਦਾਂ ਦੀ ਹੀ ਮਿਲ ਗਈ ਅਤੇ ਕਲਰ ਵੀ ਬਹੁਤ ਵਧੀਆ ਸੀਗਾ ਅਤੇ ਰੇਟ ਵੀ ਬਹੁਤ ਵਧੀਆ ਸੀਗਾ ਨਾ ਜ਼ਿਆਦਾ ਸੀਗਾ ਅਤੇ ਮੈਨੂੁੰ ਬਹੁਤ ਵਧੀਆ ਲੱਗਿਆ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ